ਮੋਹਾਲੀ ਜ਼ਿਲ੍ਹੇ ਦੇ ਵਿੱਚ ਸਿਹਤ ਕੇਂਦਰ ਬਹੁਤ ਵਧੀਆ ਹਨ ਇੱਕ ਨਹੀਂ ਅਨੇਕਾਂ ਹੀ ਸਿਹਤ ਕੇਂਦਰ ਹਨ ਜਿੱਥੋਂ ਕਿ ਹਰ ਇੱਕ ਵਿਅਕਤੀ ਹੈ ਜਿਹੜਾ ਉਹ ਆਪਣੇ ਇਲਾਜ ਲਈ ਸਹੂਲਤ ਪ੍ਰਦਾਨ ਪ੍ਰਵਾਨ ਕਰਦਾ ਹੈ ਕਿਉਂਕਿ ਬਹੁਤ ਸਾਰੇ ਅਜਿਹੇ ਜ਼ਿਲ੍ਹੇ ਹਨ ਜਿੱਥੇ ਕਿ ਇਹ ਸਹੂਲਤਾਂ ਉਪਲਬਧ ਨਹੀਂ ਹਨ ਮੋਹਾਲੀ ਦੇ ਵਿੱਚ ਹਰ ਇੱਕ ਸਹੂਲਤ ਉਪਲਬਧ ਹੋਣ ਕਾਰਨ ਹੋਰ ਜ਼ਿਲ੍ਹਿਆਂ ਤੋਂ ਪੂਰੇ ਪੰਜਾਬ ਤੋਂ ਤਕਰੀਬਨ ਤਕਰੀਬਨ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਜੋ ਵਿਅਕਤੀ ਹਨ ਉਹ ਮੋਹਾਲੀ ਤੋਂ ਹੀ ਸਿਹਤ ਸਿਹਤ ਦੇ ਸੰਬੰਧ ਵਿੱਚ ਜੋ ਮੈਂ ਸਹੂਲਤ ਹੈ ਉਹ ਲੈਣ ਦੇ ਇੱਛੁਕ ਰਹਿੰਦੇ ਹਨ ਕਿਉਂਕਿ ਇੱਥੇ ਮੋਹਾਲੀ ਚੰਡੀਗੜ੍ਹ ਜੋ ਪੀ ਜੀ ਆਈ ਹੈ ਚੰਡੀਗੜ੍ਹ ਦੇ ਵਿੱਚ ਉਹ ਵੀ ਮੋਹਾਲੀ ਦੇ ਨਜ਼ਦੀਕ ਹੈ ਪੇਸ਼ੈਂਟ ਨੂੰ ਜੋ ਸ਼ਿਫਟ ਕਰਨ ਦਾ ਪ੍ਰੋਗਰਾਮ ਹੈ ਉਹ ਵੀ ਨੇੜੇ ਹੀ ਪ੍ਰਦਾਨ ਹੋ ਜਾਂਦਾ ਹੈ ਜਿਸ ਕਾਰਨ ਹਰ ਇੱਕ ਵਿਅਕਤੀ ਹੈ ਜੋ ਮੋਹਾਲੀ ਚੰਡੀਗੜ੍ਹ ਤੋਂ ਸਹੂ ਸਿਹਤ ਸਹੂਲਤ ਹੈ ਜੋ ਉਹ ਲੈਣ ਦਾ ਇੱਛੁਕ ਰਹਿੰਦਾ ਹੈ ਅਤੇ ਮ ਮੋਹਾਲੀ ਵਿਖੇ ਆਉਣ ਜਾਣ ਦਾ ਜੋ ਆਵਾਜਾਈ ਦਾ ਸਾਧਨ ਹੈ ਉਹ ਵੀ ਸੌਖਾ ਹੈ ਕਿਉਂਕਿ ਹਰ ਇੱਕ ਜ਼ਿਲ੍ਹੇ ਤੋਂ ਹਰ ਇੱਕ ਸਥਾਨ ਤੋਂ ਮੋਹਾਲੀ ਵਿਖੇ ਆਵਾਜਾਈ ਬੱਸਾਂ ਰਾਹੀਂ ਬਹੁਤ ਜ਼ਿਆਦਾ ਹੈ ਚੁਣੌਤੀਆਂ ਤਕਰੀਬਨ ਘੱਟ ਹੀ ਹਨ ਮੌਕੇ ਬਹੁਤ ਜ਼ਿਆਦਾ ਹਨ ਕਿਉਂਕਿ ਸਹੂ ਸਹੇਲ ਸਿਹਤ ਕੇਂਦਰ ਜੋ ਹਸਪਤਾਲ ਹਨ ਉਹ ਬਹੁਤ ਜ਼ਿਆਦਾ ਹਨ ਅਤੇ ਵੱਡੇ ਲੈਵਲ ਦੇ ਹਨ ਇਸ ਕਰਕੇ ਜੋ ਵੀ ਵਿਅਕਤੀ ਜਿਸਦਾ ਕਿ ਆਪਣੇ ਜ਼ਿਲ੍ਹੇ ਵਿੱਚ ਇਲਾਜ ਨਹੀਂ ਹੋ ਸਕਦਾ ਉਹ ਸਿਹਤ ਦੀ ਜੋ ਜੋ ਸਹੂਲਤ ਹੈ ਉਹ ਲੈਣ ਲਈ ਮੋਹਾਲੀ ਵਿਖੇ ਜ਼ਰੂਰ ਆਉਂਦਾ ਹੈ